ਰੂਪਨਗਰ ਜ਼ਿਲ੍ਹੇ ਵਿੱਚ ਆਵਾਜਾਈ ਦੇ ਮੁੱਖ ਕਈ ਵਿਕਲਪ ਹਨ ਜਿਵੇਂ ਕਿ ਸੜਕਾਂ ਉੱਤੇ ਗੱਡੀਆਂ ਅਤੇ ਮੋਟਰਸਾਈਕਲ ਨਾਲ਼ ਲੋਕ ਆਪਣਾ ਆਪਣਾ ਇੱਧਰ ਤੋਂ ਉੱਧਰ ਜਾਂਦੇ ਹਨ ਰੇਲਵੇ ਸਟੇਸ਼ਨਾਂ 'ਤੇ ਰੇਲ ਗੱਡੀਆਂ ਵੀ ਹੁੰਦੀਆਂ ਹਨ ਰੂਪਨਗਰ ਵਿੱਚ ਕਈ ਰੇਲ ਗੱਡੀਆਂ ਜਾਂਦੀਆਂ ਹਨ ਹਵਾਈ ਅੱਡਾ ਤਾਂ ਰੂਪਨਗਰ ਵਿੱਚ ਹੈ ਨਹੀਂ ਪਰ ਰੂਪਨਗਰ ਦੇ ਨੇੜੇ ਚੰਡੀਗੜ੍ਹ ਵਿੱਚ ਇੱਕ ਹਵਾਈ ਅੱਡਾ ਪੈਂਦਾ ਹੈ ਜਨਤਕ ਆਵਾਜਾਈ ਆਮ ਤੌਰ 'ਤੇ ਸਾਈਕਲਾਂ ਉੱਤੇ ਹੀ ਜਾਂਦੇ ਹਨ ਇੱਕ ਆਮ ਆਦਮੀ ਲਈ ਵਿਕਲਪ ਨਾ ਤਾਂ ਬਹੁਤੇ ਸਸਤੇ ਹਨ ਨਾ ਬਹੁਤੇ ਮਹਿੰਗੇ ਹਨ ਇੱਕ ਆਮ ਆਦਮੀ ਆਰਾਮ ਨਾਲ ਹਰ ਹਰ ਵਿਕਲਪ ਨੂੰ ਮੰਨ ਸਕਦਾ ਹੈ ਬਹੁਤ ਸਾਰੀਆਂ ਚੁਣੌਤੀ ਇਸ ਨਾਲ ਬਹੁਤ ਸਾਰੀਆਂ ਚੁਣੌਤੀਆਂ ਜੁੜੀਆਂ ਹਨ